ਅੱਜ ਕੱਲ੍ਹ ਦੇ ਆਰਟੀਫਿਸ਼ੀਅਨ ਐਂਟਰਸ ਜੈਨਸ ਯੁੱਗ ਵਿੱਚ ਇੱਕ ਵਿੱਚ ਹਾਈਟੈਕ ਹੋਣਾ ਬਹੁਤ ਲਾਜ਼ਮੀ ਹੈ ਕਿਸਾਨੀ ਵਿੱਚ ਵੀ ਨਵੀਆਂ ਨਵੀਆਂ ਤਕਨੀਕਾਂ ਆ ਚੁੱਕੀਆਂ ਹਨ ਜਿਵੇਂ ਕਿ ਆਟੋਮੈਟਿਕ ਨਵੀਂ ਅਤੇ ਤਾਪਮਾਨ ਨੂੰ ਵੇਖ ਕੇ ਪਾਣੀ ਦੀ ਸਿੰਚਾਈ ਵਾਲਾ ਫੁਹਾਰਾ ਸਿਸਟਮ ਚਾਲੂ ਹੋਣਾ ਅਤੇ ਪਾਣੀ ਵਾਲੀ ਹੋਂਦ ਵਿੱਚ ਪਾਣੀ ਘਟਣ 'ਤੇ ਸੋਲਰ ਸਿਸਟਮ ਵਾਲੀ ਸਬਮਰਸੀਵੱਲ ਮੋਟਰ ਦਾ ਆਪਣੇ ਆਪ ਚੱਲਣਾ ਇੱਕ ਆਮ ਗੱਲ ਹੈ ਮੈਂ ਭਵਿੱਖ ਵਿੱਚ ਨਰਮੇ ਦੀ ਖੇਤੀ ਲਈ ਆਰਟੀਫਿਸ਼ਅਲ ਦੀ ਵਰਤੋਂ ਨਾਲ ਕੱਖ ਜਾਂ ਨਦੀਨਾਂ ਨੂੰ ਪੁੱਟਣ ਵਾਲੀ ਮਸ਼ੀਨ ਵੇਖਣਾ ਚਾਹੁੰਦੀ ਹਾਂ ਅਤੇ ਇੱਕ ਨਰਮਾ ਚੁਗਣ ਵਾਲੀ ਮਸ਼ੀਨ ਦੀ ਵੀ ਮੰਗ ਕਰਦੀ ਹਾਂ